ਸਿਨਾਰੀਓ ਤੁਸੀਂ ਆਪਣੇ ਬਜ਼ੁਰਗ ਗੁਆਂਡੀ ਨੂੰ ਆਧਾਰ ਕਾਰਡ ਲਈ ਅਰਜੀ ਦੇਣ 'ਚ ਮਦਦ ਕਰ ਰਹੇ ਹੋ ਪਰ ਤੁਹਾਨੂੰ ਯਕੀਨ ਨਹੀਂ ਹੈ ਕਿ ਉਹਨਾਂ ਨੂੰ ਦਾਖਲੇ ਲਈ ਕਿੱਥੇ ਲਿਜਾਣਾ ਹੈ ਐਕਚੁਲੀ ਮੈਨੂੰ ਕੀ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਨਾਲ ਗੱਲ ਕਰ ਰਹੇ ਹੋ ਆਪਣੇ ਬਜ਼ੁਰਗ ਗਆਂਢੀ ਨੂੰ ਦਾਖਲੇ ਲਈ ਲਿਜਾਣ ਲਈ ਨਜ਼ਦੀਕੀ ਅਧਾਰ ਦਾਖਲਾ ਕੇਂਦਰ ਦਾ ਪਤਾ ਲਗਾਉਣ ਲਈ ਸਹਾਇਤਾ ਮੰਗ ਰਹੇ ਹੋ ਅਤੇ ਉਹਨਾਂ ਨੂੰ ਲਿਜਾਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਚਰਚਾ ਕਰ ਰਹੇ ਹੋ ਹਾਂਜੀ ਰਾਹੁਲ ਹੈਲੋ ਰਾਹੁਲ ਵੈਰੀ ਗੁਡ ਮੋਰਨਿੰਗ ਮੈਂ ਹੋਰ ਘਰ ਸਭ ਠੀਕ ਠਾਕ ਹੈ ਅੱਛਾ ਅਤੇ ਮੈਂ ਤੈਨੂੰ ਇਹ ਪੁੱਛ ਰਿਹਾ ਸੀਗਾ ਤੈਂ ਸੁਵਿਧਾ ਸੈਂਟਰ ਵਿੱਚ ਕੰਮ ਕੀਤਾ ਹੋਇਆ ਹੈਗਾ ਅਤੇ ਮੇਰੇ ਨਾ ਡੈਡੀ ਦਾ ਆਧਾਰ ਕਾਰਡ ਮੈਂ ਅਪਡੇਟ ਕਰਵਾਉਣਾ ਸੀਗਾ ਅਤੇ ਉਸ ਮੁਤਾਬਿਕ ਮੈਨੂੰ ਥੋੜ੍ਹਾ ਪ੍ਰੋਸੀਜਰ ਦੱਸ ਦਿਓ ਵੀ ਕਿਸ ਤਰ੍ਹਾਂ ਹੋਏਗਾ ਅਤੇ ਕੋਈ ਰਾਹੁਲ ਗੱਲ ਕਰ ਰਿਹਾ ਹੈਗਾ ਰਾਹੁਲ ਕਰੇਗਾ ਹਾਂਜੀ ਹੈਲੋ ਦੇਵ ਤੁਸੀਂ ਇਸ ਤਰ੍ਹਾਂ ਕਰਨਾ ਵੀ ਪਹਿਲਾਂ ਜੋ ਆਧਾਰ ਕਾਰਡ ਦੇ ਸੰਬੰਧੀ ਅਪਡੇਟ ਕਰਵਾਉਣਾ ਗਾ ਉਸ ਤੋਂ ਪਹਿਲਾਂ ਤੁਸੀਂ ਇੱਕ ਔਨਲਾਈਨ ਟੋਕਨ ਬੁੱਕ ਕਰਵਾ ਲੈਣਾ ਗਾ ਜੇ ਤੁਸੀਂ ਆਨਲਾਈਨ ਟੋਕਨ ਬੁੱਕ ਕਰਵਾਓਗੇ ਤਾਂ ਤੁਹਾਨੂੰ ਉੱਥੇ ਜਿਹੜਾ ਹੋਏਗਾ ਉਹ ਤੁਹਾਡਾ ਟਾਈਮ ਵੇਸਟ ਵੱਧ ਜਾਵੇਗਾ ਜੇ ਤੁਸੀਂ ਆਨਲਾਈਨ ਲੋਕਾਂ ਤੋਂ ਬਿਨਾਂ ਜਾਵੋਗੇ ਸਿੱਧਾ ਉੱਥੇ ਆਨਲਾਈਨ ਟੋਕਣ ਤੋਂ ਬਿਨਾਂ ਜਾਵੋਗੇ ਸ ਸਿੱਧਾ ਜਾਵੋਗੇ ਤਾਂ ਤੁਹਾਨੂੰ ਉੱਥੇ ਰਸ਼ ਬਹੁਤ ਹੋਏਗਾ ਤੁਹਾਨੂੰ ਉਹਦੇ ਰਸਤੇ ਵਿੱਚ ਸਟਰਗਲ ਕਰਨਾ ਪਏਗਾ ਉੱਥੇ ਲਾਇਨ ਦੇ ਵਿੱਚ ਖੜ੍ਹਨਾ ਪਏਗਾ ਤਾਂ ਬਜ਼ੁਰਗਾਂ ਨੂੰ ਵੀ ਔਖਾ ਹੋ ਜੇਗਾ ਖੜ੍ਹਨਾ ਉਹਦੇ ਵਿੱਚ ਲਾਇਨ ਦੇ ਵਿੱਚ ਅਤੇ ਅਸੀਂ ਤੁਸੀਂ ਨਾ ਪਹਿਲਾਂ ਆਨਲਾਈਨ ਦੇ ਵਿੱਚ ਟੋਕਨ ਬੁਕ ਕਰੋ ਤੁਸੀਂ ਡੇਟਸ ਦੇਖ ਲਓ ਵੀ ਡੇਟਸ ਦੇ ਵਿੱਚ ਕਿਹੜਾ ਟਾਇਮ ਤੁਹਾਨੂੰ ਮਿਲ ਰਿਹਾ ਹੈਗਾ ਅਤੇ ਕਿਹੜੀ ਡੇਟ ਮਿਲ ਰਹੀ ਹੈਗੀ ਜਿਹੜਾ ਡੇਟ ਮਿਲ ਰਹੀ ਹੈ ਅਤੇ ਟਾਇਮ ਉਹਨੂੰ ਬੁੱਕ ਕਰਦੋ ਉਸ ਹਿਸਾਬ ਦੇ ਨਾਲ ਉਹਦੀ ਰਸੀਵਿੰਗ ਹੋਜੂ ਅਤੇ ਉਸਨੂੰ ਤੁਸੀਂ ਉਹਦੇ ਵਿੱਚ ਸੁਵਿਧਾ ਸੈਂਟਰ 'ਚ ਚਲੇ ਜਾਣਾ ਸੁਵਿਧਾ ਸੈਂਟਰ 'ਚ ਜਾਣ ਸੰਬੰਧੀ ਉੱਥੇ ਜਾ ਕੇ ਤੁਸੀਂ ਉਹ ਟੋਕਨ ਉਹਨਾਂ ਨੂੰ ਦਿਖਾ ਦੇਣਾ ਗਾ ਵੀ ਮੈਂ ਆਨਲਾਈਨ ਕਰਵਾਇਆ ਸੀਗਾ ਅਤੇ ਨਾਲ ਅਸੀਂ ਆਧਾਰ ਅਪਡੇਟ ਕਰਵਾ ਲੈਣਾ ਗਾ ਇਸ ਸੰਬੰਧੀ ਜਿਹੜੇ ਜ਼ਰੂਰੀ ਦਸਤਾਵੇਜ਼ ਨੇਗੇ ਉਹ ਤੁਸੀਂ ਨਾਲ ਲੈ ਜਿਓ ਅਤੇ ਇੱਕ ਤਾਂ ਉਹਨਾਂ ਦੇ ਫਿੰਗਰ ਪ੍ਰਿੰਟ ਹੋਣਗੇ ਅਤੇ ਉਹ ਤੁਸੀਂ ਨਾਲ ਜ਼ਰੂਰ ਲੈ ਕੇ ਜਾਇਓ ਫਿੰਗਰ ਪ੍ਰਿੰਟ ਲੈਣ ਦੀ ਅੰਗੂਠੇ ਵਗੈਰਾ ਉਹਨਾਂ ਦੇ ਹੱਥ ਸਵਾਰ ਕੇ ਚੰਗੀ ਤਰ੍ਹਾਂ ਸਾਫ ਕਰਾ ਕੇ ਅਤੇ ਉਹਦੇ ਨਾਲ ਉਸਦੀ ਨਾਲ ਫੋਟੋ ਹੋਏਗੀ ਅਪਡੇਟ ਅਤੇ ਉਸ ਤਰ੍ਹਾਂ ਦਾ ਇਹਨਾਂ ਨੂੰ ਬਣਾ ਕੇ ਇਹਨਾਂ ਦੀ ਉਹ ਲੈ ਜਿਓ ਅਤੇ ਲਿਜਾਣ ਸੰਬੰਧੀ ਇੱਕ ਇਹ ਸੀਗਾ ਵੀ ਤੁਸੀਂ ਇਹਨਾਂ ਨੂੰ ਗੱਡੀ 'ਚ ਲਿਜਾ ਸਕਦੇ ਹੋ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਹੈਗਾ ਅਤੇ ਬਿਮਾਰ ਠਮਾਰ ਹੋਗੇ ਫਿਰ ਔਖਾ ਗਾ ਅਤੇ ਇਸ ਕਰਕੇ ਬੈਟਰ ਇਹੀ ਆ ਵੀ ਤੁਸੀਂ ਇਹਨਾਂ ਨੂੰ ਗੱਡੀ 'ਚ ਲੈ ਕੇ ਜਾਓ ਆਪਣੇ 'ਚ ਅਤੇ ਔਰ ਹੋ ਸਕੇ ਤਾਂ ਗਰਮੀ ਦਾ ਮੌਸਮ ਹੋਣ ਦੇ ਕਾਰਨ ਸਵੇਰੇ ਜਲਦੀ ਜਾਓ ਸਵੇਰਾ ਜਿਹੜੇ ਅਰਲੀ ਮੋਰਨਿੰਗ ਹੁੰਦੇ ਨੇਗੇ ਇਹ ਆਵਰਜ ਜ਼ਿਆਦਾ ਵਧੀਆ ਹੁੰਦੇ ਨੇਗੇ ਤੁਸੀਂ ਉਹਨਾਂ ਟਾਈਮ ਦੇ ਵਿੱਚ ਜਾਓ ਅਤੇ ਜਾ ਕੇ ਤੁਸੀਂ ਅਪਡੇਟ ਕਰਵਾ ਲਓ ਠੀਕ ਆ ਜੀ ਰਾਹੁਲ ਥੈਂਕ ਯੂ ਥੈਂਕ ਯੂ ਸੋ ਮਚ ਓਕੇ ਜੀ